ਸਤਿ ਸ਼੍ਰੀ ਅਕਾਲ ਜੀ ਪੰਜਾਬ ਦੀ ਮਾਂ ਬੋਲੀ ਪੰਜਾਬੀ ਹੈ ਪੰਜਾਬੀ ਭਾਸ਼ਾ ਉੱਤੇ ਖੇਤਰੀ ਬੋਲੀਆਂ ਦਾ ਬਹੁਤ ਹੀ ਪ੍ਰਭਾਵ ਪਿਆ ਹੈ ਕਿਸੇ ਖੇਤਰ ਜਾਂ ਇਲਾਕੇ ਦੀ ਬੋਲੀ ਨੂੰ ਉਪ ਬੋਲੀ ਕਿਹਾ ਜਾਂਦਾ ਹੈ ਜਿਵੇਂ ਕਿ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਮਾਝੀ ਬੋਲੀ ਜਾਂਦੀ ਹੈ ਰੋਪੜ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਪੁਆਧੀ ਕਾਂਗੜਾ ਅਤੇ ਜੰਮੂ ਦੇ ਵਿੱਚ ਡੋਗਰੀ ਰਾਵਲਪਿੰਡੀ ਜੇਹਲਮ ਦੇ ਵਿੱਚ ਪੋਠੋਹਾਰੀ ਨਵਾਂਸ਼ਹਿਰ ਕਪ ਅਤੇ ਕਪੂਰਥਲਾ ਦੇ ਵਿੱਚ ਦੁਆਬੀ ਫਰੀਦਕੋਟ ਅਤੇ ਬਠਿੰਡਾ ਦੇ ਵਿੱਚ ਮਲਵਈ ਇਹ ਭਾਸ਼ਾਵਾਂ ਖੇਤਰ ਦੇ ਆਧਾਰ 'ਤੇ ਹੀ ਕੁਝ ਨਵੇਂ ਸ਼ਬਦ ਗ੍ਰਹਿਣ ਕਰ ਲੈਂਦੀਆਂ ਹਨ ਸਮਾਚਾਰ ਪੱਤਰਾਂ ਅਤੇ ਪਾਠ ਪੁਸਤਕਾਂ ਦੇ ਲਈ ਮਾਝੀ ਬੋਲੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ਕਿ ਟਕਸਾਲੀ ਭਾਸ਼ਾ ਵੀ ਕਿਹਾ ਜਾਂਦਾ ਹੈ ਪੰਜਾਬੀ ਬੋਲੀ ਤੋਂ ਬਿਨਾ ਤਿਉਹਾਰ ਗੀਤ ਮੇਲੇ ਰੁੱਤਾਂ ਸਭ ਫਿੱਕੇ ਲੱਗਦੇ ਹਨ ਜੇਕਰ ਅਸੀਂ ਪੰਜਾਬੀ ਦੇ ਇਤਿਹਾਸ ਨੂੰ ਦੇਖੀਏ ਤਾਂ ਪੰਜਾਬੀ ਦੇ ਹਿੰਦ ਆਰੀਆ ਬੋਲੀ ਹੋਣ ਦੇ ਵੀ ਜਾਣਕਾਰੀ ਮਿਲਦੀ ਹੈ ਸਮੇਂ ਦੇ ਬਦਲਾਅ ਨੇ ਪੰਜਾਬੀ ਭਾਸ਼ਾ ਉੱਤੇ ਕਾਫੀ ਪ੍ਰਭਾਵ ਪਾਇਆ ਹੈ ਇਹ ਬੋਲੀ ਅੰਗਰੇਜ਼ੀ ਅਤੇ ਹਿੰਦੀ ਜਿਹੀਆਂ ਭਾਸ਼ਾਵਾਂ ਤੋਂ ਕਾਫੀ ਪ੍ਰਭਾਵਿਤ ਹੋਈ ਹੈ ਪੰਜਾਬੀ ਦੇ ਵਿੱਚ ਬਹੁਤ ਸਾਰੇ ਸ਼ਬਦ ਹਿੰਦੀ ਅਤੇ ਉਰਦੂ ਦੇ ਹਨ ਗੌਰ ਨਾਲ ਪੜ੍ਹਨ 'ਤੇ ਸਾਨੂੰ ਪੰਜਾਬੀ ਦੇ ਵਿੱਚ ਡੱਚ ਅਤੇ ਸਪੈਨਿਸ਼ ਭਾਸ਼ਾ ਦੇ ਸ਼ਬਦ ਵੀ ਪੜ੍ਹਨ ਨੂੰ ਮਿਲਦੇ ਹਨ ਇਸ ਭਾਸ਼ਾ ਦੇ ਉੱਤੇ ਪਹਾੜੀ ਭਾਸ਼ਾ ਦਾ ਵੀ ਪ੍ਰਭਾਵ ਹੈ ਧੰਨਵਾਦ ਜੀ